ਹੈਲੋ ਹਾਂਜੀ ਮੇਰੀ ਗੱਲ ਫਲਿੱਪਕਾਰਡ ਕਸਟਮਰ ਕੇਅਰ ਨਾਲ ਹੋ ਰਹੀ ਹੈ ਹਾਂਜੀ ਹਾਂਜੀ ਸਰ ਮੈਂ ਨਾ ਸਰ ਲਾਸਟ ਟਾਈਮ ਇੱਕ ਹੈਡਫ਼ੋਨ ਔਡਰ ਕੀਤਾ ਸੀਗਾ ਜੋ ਕੀ ਸਰ ਕਾਫੀ ਡੈਮਿਜ ਨਿਕਲਿਆ ਹਾਂਜੀ ਹਾਂਜੀ ਸਰ ਉਹਦਾ ਨਾ ਐਕਚੁਲੀ ਮੈਂ ਰਿਵਿਊ ਦੇਖ ਕੇ ਕੀਤਾ ਸੀਗਾ ਰਿਵਿਊ ਤਾਂ ਉਹਦੇ ਕਾਫੀ ਅੱਛੇ ਸੀਗੇ ਬਟ ਸਰ ਜਦੋਂ ਪ੍ਰੋਡਕਟ ਡਿਲੀਵਰ ਹੋਇਆ ਅਤੇ ਕਿਸੇ ਕੰਮ ਦਾ ਨਹੀਂ ਸੀਗਾ ਹਾਂਜੀ ਸਰ ਜਿਵੇਂ ਕਿ ਸਰ ਉਹਦੇ 'ਚ ਦਿੱਕਤ ਇਹ ਆ ਰਹੀ ਸੀ ਕਿ ਦੋ ਸਾਈਡਾਂ ਹੁੰਦੀਆਂ ਨੇ ਤਾਂ ਰਾਈਟ ਵਾਲੀ ਸਾਈਡ ਬਿਲਕੁਲ ਵੀ ਕੰਮ ਨਹੀਂ ਕਰ ਰਹੀ ਅਤੇ ਜਿਹੜੀ ਲੈਫਟ ਵਾਲੀ ਸਾਈਡ ਕੰਮ ਕਰ ਵੀ ਰਹੀ ਸੀਗੀ ਉਹਦੇ 'ਚ ਸਰ ਆਵਾਜ਼ ਨਹੀਂ ਕਲੀਅਰ ਆ ਰਹੀ ਸੀਗੀ ਅਤੇ ਸਰ ਉਹਦੀ ਆਊਟਰ ਜਿਹੜਾ ਬੋਕਸ ਸੀਗਾ ਸਰ ਉਹ ਵੀ ਬਿਲਕੁਲ ਹੀ ਮਤਲਬ ਡੈਮੇਜ ਸੀਗਾ ਮਤਲਬ ਕਿਸੇ ਵੀ ਸਰ ਜਿਸ ਹਿਸਾਬ ਨਾਲ ਸਰ ਉਹਦੇ ਰਿਵਿਊ ਆਏ ਸੀਗੇ ਨਾ ਉਸ ਹਿਸਾਬ ਦਾ ਸਰ ਪ੍ਰੋਡਕਟ ਨਹੀਂ ਹੈਗਾ ਹਾਂਜੀ ਅ ਕੰਪਨੀ ਸਰ ਰੈੱਡਮੀ ਕੰਪਨੀ ਦਾ ਸੀਗਾ ਸਰ ਮੈਂ ਚੇਂਜ ਕਰ ਤਾਂ ਦਿੰਦਾ ਪਰ ਸਰ ਉਹ ਦੇਖੋ ਸਰ ਮੈਨੂੰ ਜ਼ਰੂਰੀ ਚਾਹੀਦੇ ਸੀਗੇ ਮੇਰਾ ਉਹਦੇ ਕਾਰਨ ਕਾਫੀ ਕੰਮ ਰੁੱਕ ਰਿਹਾ ਸੀਗਾ ਬਟ ਸਰ ਮੈਨੂੰ ਮਤਲਬ ਉਹਦਾ ਕੋਈ ਫਾਇਦਾ ਨਹੀਂ ਹੋਇਆ ਇਹਦੇ ਕਰਕੇ ਸਰ ਮੇਰੀ ਇੱਕ ਟ੍ਰੇਨ ਵੀ ਛੁੱਟ ਗਈ ਮਤਲਬ ਮੈਂ ਆਪਣੀ ਟ੍ਰੇਨ ਛੱਡ ਤੀ ਕਿ ਚੱਲ ਮੇਰਾ ਪ੍ਰੋਡਕਟ ਆ ਜੇਗਾ ਮੈਨੂੰ ਲੋੜ ਆ ਅਤੇ ਮੈਂ ਲੈ ਕੇ ਜਾਊਂਗਾ ਪਰ ਸਰ ਨਾ ਟਾਈਮ ਸਿਰ ਡਿਲੀਵਰੀ ਆਈ ਜੇ ਡਿਲੀਵਰੀ ਆਈ ਵੀ ਹੈ ਤਾਂ ਉਹ ਵੀ ਕਿਸੇ ਕੰਮ ਦਾ ਪ੍ਰੋਡਕਟ ਨਹੀਂ ਹੈ ਹਾਂਜੀ ਅਤੇ ਠੀਕ ਹੈ ਸਰ ਤੁਸੀਂ ਕੰਪਨੀ ਨਾਲ ਇੱਕ ਵਾਰੀ ਗੱਲ ਕਰ ਲਿਓ ਠੀਕ ਹੈ ਸਰ ਧੰਨਵਾਦ